ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਹਰ ਘਰ ਦੇ ਵਿੱਚ ਮੋਟਰਸਾਈਕਲ ਲਾਜ਼ਮੀ ਹੈ ਅਤੇ ਅਸੀਂ ਆਪਣੇ ਘਰੇਲੂ ਕੰਮਾਂ ਦੇ ਲਈ ਉਸ ਨੂੰ ਵਰਤਦੇ ਹਾਂ ਕਹਿਣ ਦਾ ਮਤਲਬ ਕਿਤੇ ਆਉਣ ਜਾਣ ਦੇ ਲਈ ਅਸੀਂ ਬਾਈਕਿੰਗ ਕਰਦੇ ਹਾਂ ਬਾਈਕਿੰਗ ਕਰਨ ਤੋਂ ਪਹਿਲਾਂ ਸਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਬਾਈਕਿੰਗ ਕਰਨ ਵੇਲੇ ਸਾਡੀ ਬਾਈਕ ਦੇ ਵਿੱਚ ਮਲਟੀ ਟੂਲ ਕਿੱਟ ਹੋਣਾ ਬਹੁਤ ਜ਼ਰੂਰੀ ਹੈ ਕਹਿਣ ਦਾ ਮਤਲਬ ਕੁੱਝ ਔਜਾਰ ਹੋਣੇ ਬਹੁਤ ਜ਼ਰੂਰੀ ਹਨ ਜਿਹਨਾਂ ਦੀ ਮਦਦ ਨਾਲ ਜੇਕਰ ਸਾਡੀ ਬਾਈਕ ਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਅਸੀਂ ਉਸ ਨੂੰ ਠੀਕ ਕਰ ਸਕਦੇ ਹਾਂ ਮਲਟੀ ਟੂਲ ਕਿੱਟ ਦੇ ਵਿੱਚ ਜਿਵੇਂ ਕਿ ਚਾਬੀਆਂ ਬੋਕਸ ਪਾਨੇ ਪਲਾਸ ਪੇਚਕਸ ਇਹ ਚੀਜ਼ਾਂ ਹੋਣੀਆਂ ਬਹੁਤ ਹੀ ਜ਼ਰੂਰੀ ਹਨ ਸ਼ੜਕ 'ਤੇ ਸਾਡੀ ਕਈ ਵਾਰ ਜਦੋਂ ਸਾਈਕਲ ਖਰਾਬ ਹੋ ਜਾਂਦੀ ਹੈ ਤਾਂ ਅਸੀਂ ਉਹਦੀ ਸਮੱਸਿਆ ਦਾ ਹੱਲ ਕਰਨ ਦੇ ਲਈ ਸਭ ਤੋਂ ਪਹਿਲਾਂ ਉਸ ਨੂੰ ਸਾਈਕਲ ਰਿਪੇਅਰ ਦੁਕਾਨ 'ਤੇ ਲੈ ਕੇ ਜਾਂਦੇ ਹਾਂ ਤਾਂ ਜੋ ਸਮੱਸਿਆ ਦਾ ਹੱਲ ਹੋ ਸਕੇ ਯਾਤਰਾ ਦੇ ਦੇ ਦੌਰਾਨ ਸਾਡੀ ਸਾਈਕਲ ਕਦੇ ਵੀ ਖਰਾਬ ਨਹੀਂ ਹੋਈ ਇਸ ਚੀਜ਼ ਦਾ ਅਨੁਭਵ ਅਸੀਂ ਨਹੀਂ ਕੀਤਾ